ਮੈਨੂੰ ਪੇਂਟਿੰਗ ਕਰਨ ਦਾ ਬਹੁਤ ਹੀ ਸ਼ੌਂਕ ਹੈ ਮੈਂ ਪੇਂਟਿੰਗ ਰਾਹੀਂ ਆਪਣੀ ਕਲਪਨਾ ਨੂੰ ਸੋਹਣੇ ਤਰੀਕੇ ਨਾਲ ਜਾਹਿਰ ਕਰਦੀ ਹਾਂ ਪੇਂਟਿੰਗ ਇੱਕ ਅਜਿਹਾ ਕਲ ਕਲਾ ਹੈ ਕਿ ਅਸੀਂ ਆਪਣੇ ਕੰਮ ਵਿੱਚ ਯਥਾਰਥਵਾਦ ਅਤੇ ਅਮੂਰਤਤਾ ਸੰਤੁਲਿਤ ਬਣਾ ਕੇ ਚੱਲਦੇ ਹਾਂ ਇੱਕ ਕਲਾਕਾਰ ਪੇਂਟਿੰਗ ਰਾਹੀਂ ਆਪਣੇ ਮਨ ਦੇ ਭਾਵਾਂ ਨੂੰ ਪੇਸ਼ ਕਰ ਸਕਦਾ ਹੈ ਪੇਂਟਿੰਗ ਰਾਹੀਂ ਪੇਂਟਿੰਗ ਰਾਹੀਂ ਆਪਣੇ ਸੋਹਣੇ ਤਰੀਕੇ ਦੇ ਨਾਲ ਆਪਣੇ ਕੰਮ ਨੂੰ ਸੋਹਣੇ ਬੈਲੰਸ ਬਣਾ ਕੇ ਚਲਾ ਸਕਦੇ ਹਾਂ ਜਿਸ ਤਰ੍ਹਾਂ ਕਿ ਇੱਕ ਪੇਂਟਿੰਗ ਇੱਕ ਕਲਾਕਾਰ ਬਣਾਉਂਦਾ ਹੈ ਤਾਂ ਪੇਂਟਿੰਗ ਨੂੰ ਉਹ ਵੱਖੋ ਵੱਖ ਰੰਗਾਂ ਦੇ ਨਾਲ ਉਸਨੂੰ ਸੋਹਣੇ ਤਰੀਕੇ ਦੇ ਨਾਲ ਪੇਸ਼ ਕਰਦਾ ਹੈ ਤਾਂ ਕਿ ਦੂਸਰਾ ਜੋ ਹੈ ਪਰਸਨ ਦੂਸਰਾ ਜੋ ਮੈਂਬਰ ਹੈ ਉਸਨੂੰ ਆ ਕੇ ਉਹ ਦੇਖਦਾ ਹੈ ਦੇਖਣ ਦੇਖਣ ਦੇ ਲਈ ਉਸਨੂੰ ਤਰ੍ਹਾਂ ਤਰ੍ਹਾਂ ਦੇ ਪੇਂਟਿੰਗ ਨੂੰ ਦੇਖ ਕੇ ਉਸਦੇ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਹਾਵ ਭਾਵ ਕੌਸ਼ਲ ਉੱਠਦੇ ਹਨ ਕਈ ਪੇਂਟਿੰਗ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਕਿ ਆਪਾਂ ਉਸਨੂੰ ਦੇਖ ਕੇ ਵੀ ਸ ਉਸਨੂੰ ਦੇਖਦੇ ਸਾਰ ਹੀ ਮਨ ਦੇ ਵਿੱਚ ਕਿੰਨੇ ਸਾਰੇ ਪ੍ਰਸ਼ਨ ਜਿਹੜੇ ਹੈ ਉੱਠਦੇ ਹਨ ਤੇ ਉਸ ਪੇਂਟਿੰਗ ਦੇ ਵਿੱਚੋਂ ਉਹਨਾਂ ਪ੍ਰਸ਼ਨਾਂ ਦਾ ਜਿਹੜਾ ਹੈ ਜਵਾਬ ਸਾਨੂੰ ਸੋਹਣੇ ਤਰੀਕੇ ਦੇ ਨਾਲ ਮਿਲ ਜਾਂਦਾ ਹੈ ਇਸ ਲਈ ਅਸੀਂ ਆਪਣੇ ਕੰਮ ਵਿੱਚ ਯਥਾਰਥਵਾਦ ਅਤੇ ਅਮੂਰਤਤਾ ਨੂੰ ਸੰਤੁਲਿਤ ਬਣਾ ਕੇ ਚੱਲਦੇ ਹਾਂ ਤਾਂ ਹੀ ਤ ਸਾਡਾ ਜਿਹੜਾ ਕੰਮ ਹੈ ਉਹ ਵਧੀਆ ਤਰੀਕੇ ਦੇ ਨਾਲ ਸਫ਼ਲ ਹੋ ਸਕੇਗਾ